ਉਣੱਤੀ ਜਨਵਰੀ ਉੱਨੀ ਅਠਾਈ ਛੱਬੀ ਮਾਰਚ ਅਠਾਰਾਂ ਪਚਾਸੀ ਦੋ ਮਈ ਵੀਹ ਵੀਹ ਅਠਾਈ ਜਨਵਰੀ ਉੱਨੀ ਪਚਾਸੀ ਸੋਲ਼ਾਂ ਸਤੰਬਰ ਵੀਹ ਬਾਈ